ਮੈਂ ਪੰਜਾਬ ਵਿੱਚ ਰਹਿੰਦੀ ਹਾਂ ਮੈਂ ਟੀ ਵੀ ਉੱਤੇ ਅਕਸਰ ਖਬਰਾਂ ਦੇਖਦੀ ਰਹਿੰਦੀ ਹਾਂ ਮੈਨੇ ਟੀ ਵੀ ਉੱਤੇ ਕਾਫੀ ਸਾਰੀ ਖਬਰਾਂ ਦੇਖੀਆਂ ਹਨ ਜਿਹਨਾਂ ਦਾ ਟਾਈਟਲ ਇੰਗਲੀ ਵਿ ਇੰਗਲਿਸ਼ ਵਿੱਚ ਹੁੰਦਾ ਹੈ ਪਰ ਉਹ ਖਬਰਾਂ ਪੰਜਾਬੀ ਵਿੱਚ ਸੁਣਾਉਂਦੇ ਹਨ ਜੋ ਕਿ ਚੰਗੀ ਗੱਲ ਨਹੀਂ ਹੈ ਓਹਨਾਂ ਨੂੰ ਟਾਈਟਲ ਵੀ ਪੰਜਾਬੀ ਵਿੱਚ ਹੀ ਲਿਖਣਾ ਚਾਹੀਦਾ ਹੈ ਮੀਡੀਆ ਨੂੰ ਇਸ ਗੱਲ ਉੱਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਓਹਨਾਂ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਜੇਕਰ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਅਤੇ ਪੰਜਾਬੀ ਬੋਲਦੇ ਹਾਂ ਤਾਂ ਅਸੀਂ ਪੰਜਾਬੀ ਵਿੱਚ ਹੀ ਓਹਨਾਂ ਦਾ ਟਾਈਟਲ ਦੱਸੀਏ ਨਾ ਕਿ ਇੰਗਲਿਸ਼ ਵਿੱਚ ਪੰਜਾਬ ਵਿੱਚ ਕਾਫੀ ਸਾਰੀ ਭਾਸ਼ਾਵਾਂ ਹਨ ਪਰ ਪੰਜਾਬੀ ਸਾਡੀ ਖਾਸ ਭਾਸ਼ਾ ਹੈ ਸਾਨੂੰ ਪੰਜਾਬੀ ਹੀ ਬੋਲਣੀ ਚਾਹੀਦੀ ਹੈ ਪੰਜਾਬ ਵਿੱਚ ਸਾਨੂੰ ਰਹਿੰਦਿਆਂ ਪੰਜਾਬੀ ਬੋਲਣੀ ਚਾਹੀਦੀ ਹੈ ਅਤੇ ਪੰਜਾਬੀ ਵਿੱਚ ਹੀ ਖਬਰਾਂ ਦੀ ਹੈੱਡਲਾਈਨ ਦੱਸਣੀ ਚਾਹੀਦੀ ਹੈ ਅਤੇ ਖਬਰਾਂ ਦੱਸਣੀਆਂ ਚਾਹੀਦੀਆਂ ਹਨ ਪੰਜਾਬ ਵਿੱਚ ਕਾਫੀ ਸਾਰੇ ਸਿੱਖਿਆ ਪ੍ਰਣਾਲੀਆਂ ਹਨ ਜੋ ਪੰਜਾਬੀ ਵਿੱਚ ਹਨ ਪੰਜਾਬੀ ਓਹਨਾਂ ਵਿੱਚ ਲਾਜ਼ਮੀ ਰੱਖੀ ਗਈ ਹੈ ਸੀਗੀਆਂ ਪ੍ਰਣਾਲੀਆਂ ਬਹੁਤ ਸਾਰੀਆਂ ਹਨ ਪੰਜਾਬ ਸਰਕਾਰ ਨੇ ਸਿੱਖਿਆ ਪ੍ਰਣਾਲੀਆਂ ਉੱਤੇ ਬਹੁਤ ਜ਼ੋਰ ਪਾਇਆ ਹੈ ਪੰਜਾਬ ਵਿੱਚ ਕਈ ਸਕੂਲਾਂ ਵਿੱਚ ਪੰਜਾਬੀ ਲਾਜ਼ਮੀ ਰੱਖੀ ਗਈ ਹੈ ਪਰ ਕਈ ਬ੍ਰਿਟਿਸ਼ ਸਕੂਲ ਵੀ ਹਨ ਜਿਹਨਾਂ ਵਿੱਚ ਪੰਜਾਬੀ ਨਹੀਂ ਹੈ ਪਰ ਸਰਕਾਰ ਦੇ ਜ਼ੋਰ ਪਾਉਣ ਦੇ ਕਾਰਨ ਓਹਨਾਂ ਬ੍ਰਿਟਿਸ਼ ਸਕੂਲਾਂ ਵਿੱਚ ਵੀ ਪੰਜਾਬੀ ਨੂੰ ਪੜ੍ਹਾਇਆ ਲਿਖਾਇਆ ਜਾਂਦਾ ਹੈ ਅਤੇ ਬੋਲਿਆ ਬੋਲਣ ਲਈ ਵੀ ਸਿਖਾਇਆ ਜਾਂਦਾ ਹੈ ਜੋ ਕਿ ਬਹੁਤ ਚੰਗੀ ਗੱਲ ਹੈ ਪੰਜਾਬ ਵਿੱਚ ਰਹਿੰਦਿਆਂ ਹੀ ਸਾਨੂੰ ਪੰਜਾਬੀ ਦਾ ਉਚਾਰਨ ਕਰਨਾ ਚਾਹੀਦਾ ਹੈ ਨਾ ਕਿ ਬ੍ਰਿਟਿਸ਼ ਭਾਸ਼ਾ ਦਾ ਜੋ ਕਿ ਸਾਡੇ ਲਈ ਚੰਗੀ ਗੱਲ ਨਹੀਂ ਹੈ ਜੇਕਰ ਅਸੀਂ ਪੰਜਾਬ ਵਿੱਚ ਰਹਿੰਦਿਆਂ ਵੀ ਇੰਗਲਿਸ਼ ਬੋਲੀ ਦਾ ਇਸਤੇਮਾਲ ਕਰਦੇ ਹਾਂ ਸਾਨੂੰ ਪੰਜਾਬ ਵਿੱਚ ਰਹਿੰਦਿਆਂ ਆਪਣੀ ਅਹਿਮ ਭਾਸ਼ਾ ਦਾ ਪ੍ਰਯੋਗ ਕਰਨਾ ਚਾਹੀਦਾ ਹੈ